ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੁੱਖ ਸਮਾਜ ਭਲਾਈ ਅਤੇ ਵਿਕਾਸ ਪ੍ਰੋਗਰਾਮ ਅਤੇ ਪਹਿਲਕਦਮੀਆਂ ਬਹੁਤ ਸਾਰੀਆਂ ਹਨ ਇਸ ਖੇਤਰ ਦੇ ਲੋਕਾਂ ਨੂੰ ਸਹੂਲਤ ਦੇਣ ਵਾਲੀ ਸਰਕਾਰੀ ਸਕੀਮ ਜਿਵੇਂ ਕਿ ਰਿਟਾਇਰ ਬਜ਼ੁਰਗਾਂ ਨੂੰ ਪੈਨਸ਼ਨ ਦਿੰਦੇ ਹਨ ਅਤੇ ਲਾਡਲੀ ਬੇਟੀ ਸਕੀਮ ਵੀ ਚਲਾਈ ਹੈ ਅਤੇ ਸਿੱਖਿਆ ਲਈ ਲੋੜਵੰਦ ਵਿਦਿਆਰਥੀਆਂ ਨੂੰ ਫਰੀ ਸ਼ਿਕਸ਼ਾ ਦਿੰਦੇ ਹਨ ਅਤੇ ਉਨ੍ਹਾਂ ਲ ਲਈ ਬੁੱਕਸ ਵੀ ਫਰੀ ਹੁੰਦੀਆਂ ਹਨ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀ ਵੀ ਫਰੀ ਵਿੱਚ ਮਿਲਦੀ ਹੈ ਅਤੇ ਉਨਾਂ ਲਈ ਸਕੋਲਰਸ਼ਿਪ ਵੀ ਦਿੰਦੇ ਹਨ ਅਤੇ ਦੁਪਹਿਰ ਦੇ ਖਾਣੇ ਲਈ ਮਿੱਡ ਡੇ ਮੀਲ ਵੀ ਹੁੰਦਾ ਹੈ ਅਤੇ ਸਿਹਤ ਦੇਖ ਰੇਖ ਲਈ ਅੰਮ੍ਰਿਤਸਰ ਵਿੱਚ ਜ਼ਿਲ੍ਹੇ ਵਿੱਚ ਕਈ ਸਾਰੀਆਂ ਡਿਸਪੈਂਸਰੀ ਹੁੰਦੀਆਂ ਹਨ ਅਤੇ ਕੁਝ ਸਰਕਾਰ ਵੱਲੋਂ ਵੀ ਹੈ ਉਸ ਵਿੱਚ ਘੱਟ ਪੈਸਿਆਂ 'ਤੇ ਦਵਾਈ ਮਿਲ ਜਾਂਦੀ ਹੈ ਅਤੇ ਭਲਾਈ ਕੇਂਦਰ ਵਿਚ ਵੀ ਘੱਟ ਪੈਸਿਆਂ 'ਤੇ ਦਵਾਈ ਮਿਲ ਜਾਂਦੀ ਹੈ ਅਤੇ ਸਰਕਾਰੀ ਵਿੱਚ ਤਾਂ ਬਿਲਕੁਲ ਹੀ ਫਰੀ ਹੁੰਦੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘੱਟ ਸਸਤੇ ਹੋਸਪੀਟਲ ਵੀ ਹਨ ਜਿਵੇਂ ਕਿ ਰਾਮਦਾਸ ਹੋਸਪਿਟਲ ਅਤੇ ਬੀਬੀ ਕੌਲਾਂ ਭਲਾਈ ਕੇਂਦਰ ਅਤੇ ਗਰੀਬੀ ਘਟਾਉਣ ਲਈ ਗਰੀਬ ਲੋਕਾਂ ਨੂੰ ਫਰੀ ਵਿੱਚ ਰਾਸ਼ਨ ਵੀ ਦਿੱਤਾ ਜਾਂਦਾ ਹੈ ਅਤੇ ਉਹਨਾਂ ਲਈ ਐਜੂਕੇਸ਼ਨ ਵੀ ਲਈ ਵੀ ਪੈਸੇ ਘੱਟ ਲਿੱਤੇ ਜਾਂਦੇ ਹਨ ਅਤੇ ਜਿਹੜੀਆਂ ਅਨੁਸੂਚਿਤ ਜਾਤੀਆਂ ਹੁੰਦੀਆਂ ਹਨ ਉਹਨਾਂ ਲਈ ਪੜ੍ਹਾਈ ਬਿਲਕੁਲ ਫਰੀ ਹੁੰਦੀ ਹੈ ਅਤੇ ਉਹ ਉਚੇਰੀ ਪੜ੍ਹਾਈ ਵੀ ਹਾਸਿਲ ਕਰ ਸਕਦੇ ਹਨ ਔਰਤਾਂ ਦਾ ਸਸ਼ਕਤੀਕਰਨ ਲਈ ਉਹਨਾਂ ਲਈ ਸਕੀਮ ਵੀ ਸਰਕਾਰ ਵੱਲੋਂ ਦਿੱਤੀ ਗਈ ਸੀ ਜਿਵੇਂ ਕਿ ਲਾਡਲੀ ਬਹਿਨਾ ਅਤੇ ਸਿਲੰਡਰ ਵੀ ਦੀ ਵੀ ਸਕੀਮ ਆਈ ਸੀ ਉਸ ਵਿੱਚ ਲੋੜਵੰਦ ਔਰਤਾਂ ਨੂੰ ਫਰੀ ਵਿੱਚ ਸਿਲੰਡਰ ਦਿੱਤੇ ਗਏ ਸਨ